ਹਾਂਜੀ ਤੁਸੀਂ ਸਵਿਗੀ ਤੋਂ ਬੋਲਦੇ ਹੋ ਤੁਸੀਂ ਔਡਰ ਜਿੱਥੇ ਪਲੇਸ ਕਰਨਾ ਤੁਹਾਨੂੰ ਐਡਰੈਸ ਨਹੀਂ ਸਮਝ ਆ ਰਹੀ ਮੈਂ ਤੁਹਾਨੂੰ ਐਡਰੈਸ ਦੱਸਦੀ ਹਾਂ ਤੁਸੀਂ ਸੁਣਿਓ ਤੁਸੀਂ ਸਭ ਤੋਂ ਪਹਿਲਾਂ ਸ਼ਹੀਦਾਂ ਸਾਹਿਬ ਪਹੁੰਚ ਜਾਓ ਫਿਰ ਤੁਸੀਂ ਤਰਨ ਤਾਰਨ ਰੋਡ 'ਤੇ ਆਉਣਾ ਹੈ ਅਤੇ ਉਸ ਤੋਂ ਅੱਗੇ ਤੁਸੀਂ ਇੱਕ ਪੁੱਲ ਆਵੇਗਾ ਅਤੇ ਫਿਰ ਤੁਸੀਂ ਪੁੱਲ ਬਿਲਕੁਲ ਜਿੱਥੇ ਪੁੱਲ ਦਾ ਐਂਡ ਹੁੰਦਾ ਨਾ ਉੱਥੇ ਤੱਕ ਤੁਸੀਂ ਪਹੁੰਚੋ ਫਿਰ ਅੱਗੇ ਇੱਕ ਤੁਹਾਨੂੰ ਭੁੱਲਰ ਫਾਮ ਮਿਲੇਗਾ ਸਾਹਮਣੇ ਉਹਦੇ ਪੁੱਲ ਜਿੱਥੇ ਖਤਮ ਹੁੰਦਾ ਹੈ ਉੱਥੇ ਹੀ ਭੁੱਲਰ ਫਾਮ ਆ ਉਹਦੇ ਓਪੋਜਿਟ ਸਾਈਡ 'ਤੇ ਤੁਹਾਨੂੰ ਸੈਲੀਬਰੇਸ਼ਨ ਕਲੋਨੀ ਦਿਖੇਗੀ ਬਾਹਰ ਬੋਰਡ ਵੱਡਾ ਜ ਸਾਰਾ ਲੱਗਾ ਹੋਇਆ ਵਾ ਤੁਹਾਨੂੰ ਉੱਥੋਂ ਪਤਾ ਚੱਲ ਜਾਵੇਗਾ ਪਹਿਲਾਂ ਉੱਥੇ ਤੁਸੀਂ ਐਂਟਰ ਕਰਨਾ ਫਿਰ ਤੁਸੀਂ ਥੋੜ੍ਹਾ ਅੱਗੇ ਚਲਦੇ ਆਓ ਚਲਦੇ ਆਓ ਫਿਰ ਤੁਹਾਨੂੰ ਉੱਥੇ ਰੇਤ ਦਾ ਢੇਰ ਦਿਖੇਗਾ ਐਂਟਰੀ ਵਿੱਚ ਈ ਉੱਥੇ ਜਦੋਂ ਤੁਸੀਂ ਅੱਗੇ ਆਓਗੇ ਰੇਤ ਦੇ ਢੇਰ ਲਾਗੇ ਪਹੁੰਚੋਗੇ ਫਿਰ ਤੁਸੀਂ ਤੁਹਾਨੂੰ ਥੋੜ੍ਹੀ ਅੱਗੇ ਚੱਲ ਕੇ ਤੁਹਾਨੂੰ ਇੱਕ ਪਾਰਕ ਦਿਖੇਗੀ ਪਾਰਕ ਦੇ ਅੰਦਰ ਤੁਸੀਂ ਉਹਦੇ ਐਂਟਰ ਕਰਨਾ ਫਿਰ ਇੱਕ ਸਾਈਡ 'ਤੇ ਸਾਹਮਣੇ ਤੁਹਾਨੂੰ ਗੁਰਦੁਆਰਾ ਦਿਖਾਈ ਦੇਵੇਗਾ ਫਿਰ ਗੁਰਦੁਆਰੇ ਦੇ ਲਾਗੇ ਬਾਹਰ ਤੁਹਾਨੂੰ ਕਿੰਨੀਆਂ ਸਕੂਲ ਵੈਨਾਂ ਲੱਗੀਆਂ ਦਿਖਣਗੀਆਂ ਠੀਕ ਹੈ ਸਕੂਲ ਵੈਨਾਂ ਦੇ ਲਾਗੇ ਇੱਧਰ ਫਸਟ ਜਿਹੜਾ ਘਰ ਆਵੇਗਾ ਸਕੂਲ ਵੈਨਾਂ ਦੇ ਲਾਗੇ ਸਾਹਮਣੇ ਗੁਰਦੁਆਰੇ ਦੇ ਲਾਗੇ ਸਕੂਲ ਵੈਨਾਂ ਖੜੀਆਂ ਉਹਦੇ ਲਾਗੇ ਜਿਹੜਾ ਬਿਲਕੁਲ ਤੁਹਾਨੂੰ ਪਹਿਲਾਂ ਘਰ ਦਿਖੇਗਾ ਉਹ ਪੰਜ ਸੌ ਸਤਾਹਠ ਨੰਬਰ ਉਸ 'ਤੇ ਤੁਸੀਂ ਔਡਰ ਪਲੇਸ ਕਰਨਾ ਆਪਣਾ ਸਮਝ 'ਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਮੇਰਾ ਐਡਰੈਸ ਸਮਝ ਆ ਜਾਏ ਧੰਨਵਾਦ